ਸਤਿ ਸ਼੍ਰੀ ਅਕਾਲ ਮੇਰਾ ਨਾਮ ਸੁਨਿਧੀ ਹੈ ਔਰ ਯੋਗਾ ਦੇ ਕਰਨ ਦੇ ਫਾਇਦਿਆਂ ਬਾਰੇ ਅਸੀਂ ਅੱਜ ਗੱਲ ਕਰਾਂਗੇ ਸਵੇਰੇ ਅਸੀਂ ਰੋਜ਼ ਯੋਗਾ ਕਰਦੇ ਹਾਂ ਤਾਂ ਸਾਡੀ ਸਰੀਰ ਅਤੇ ਮਾਨਸਿਕ ਅਵਸਥਾ ਲਈ ਬਹੁਤ ਹੀ ਫਲਦਾਇਕ ਹੈ ਸਾਨੂੰ ਬਚਪਨ ਤੋਂ ਯੋਗਾ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਬਚ ਯੋਗਾ ਕਰਨ ਨਾਲ ਅਸੀਂ ਬਿਮਾਰੀਆਂ ਤੋਂ ਦੂਰ ਰਹਿੰਦੇ ਹਾਂ ਮਾਨਸਿਕ ਤਣਾਉ ਤੋਂ ਵੀ ਦੂਰ ਰਹਿੰਦੇ ਹਾਂ ਔਰ ਅਗਰ ਕੋਈ ਵਿਅਕਤੀ ਨਵਾਂ ਹੈ ਯੋਗਾ ਦਾ ਅਭਿਆਸ ਕਰ ਰਿਹਾ ਹੈ ਉਸ ਨੂੰ ਮੇਰੀ ਇਹ ਸਲਾਹ ਹੈ ਕਿ ਸ਼ੁਰੂਆਤ ਵਿੱਚ ਇਕਦਮ ਸਾਨੂੰ ਬਹੁਤ ਜ਼ਿਆਦਾ ਅਭਿਆਸ ਨਹੀਂ ਕਰਨਾ ਚਾਹੀਦਾ ਸਾਨੂੰ ਹੌਲੀ ਹੌਲੀ ਆਪਣਾ ਅਭਿਆਸ ਜਿਹੜਾ ਹੈ ਉਹ ਵਧਾਉਣਾ ਚਾਹੀਦਾ ਹੈ ਸ਼ੁਰੂ ਸ਼ੁਰੂ ਵਿੱਚ ਹਲਕਾ ਫੁਲਕਾ ਯੋਗਾ ਕਰਨ ਨਾਲ ਸਾਡੀ ਸਿਹਤ 'ਤੇ ਕੋਈ ਦੁਰਪ੍ਰਭਾਵ ਨਹੀਂ ਪੈਂਦਾ ਹੈਗਾ ਸਾਡੇ ਕੋਈ ਦਰਦ ਜਾਂ ਸਰੀਰ ਵਿੱਚ ਬਦਲਾਵ ਆਉਣ ਦੇ ਅਨੁਭਵ ਨੂੰ ਨਹੀਂ ਕਰਨਾ ਪਏਗਾ ਉਸਨੂੰ ਹੌਲੀ ਹੌਲੀ ਆਪਣੇ ਅਨੁਭਵ ਨੂੰ ਵਧਾਉਣਾ ਚਾਹੀਦਾ ਹੈ ਸ਼ੁਰੂ ਸ਼ੁਰੂ ਵਿੱਚ ਉਸਨੂੰ ਆਪਣੇ ਸਰੀਰ ਨੂੰ ਕਸਰਤ ਵਿੱਚ ਢਾਲਣਾ ਪਏਗਾ ਜਿਹਦੇ ਨਾਲ ਉਹਦੀ ਸਿਹਤ ਵਿੱਚ ਬਦਲਾਵ ਆਉਣਾ ਸ਼ੁਰੂ ਹੋਏਗਾ ਅਗਰ ਉਹ ਬਿਮਾਰ ਹੈ ਉਹਦੀ ਬਿਮਾਰੀਆਂ ਤੋਂ ਦੂਰ ਹੋਏਗਾ ਜਿਹਦੇ ਕਰਕੇ ਉਹਦੀ ਸਿਹਤ ਵਿੱਚ ਬਹੁਤ ਹੀ ਵਧੀਆ ਫਰਕ ਲੱਗਣਾ ਸੁਰੂ ਹੋਏਗਾ ਅਗਰ ਉਹ ਵਿਅਕਤੀ ਸਰੀਰ ਤੋਂ ਮੋਟਾ ਹੈ ਤਾਂ ਉਹਦਾ ਵਜਨ ਘੱਟਣਾ ਸ਼ੁਰੂ ਹੋਏਗਾ ਉਹਨੂੰ ਸਾਹ ਦੀ ਬਿਮਾਰੀ ਹੈ ਉਹਦਾ ਸਾਹ ਸਹੀ ਤਰ੍ਹਾਂ ਨਾਲ ਆਉਣਾ ਸ਼ੁਰੂ ਹੋ ਜਾਏਗਾ ਜਿਹਦੇ ਕਰਕੇ ਚਿਹਰੇ 'ਤੇ ਨਿਖਾਰ ਆਉਂਦਾ ਹੈ ਯੋਗਾ ਕਰਨਾ ਨਾਲ ਸਾਡੇ ਸ਼ ਸਰੀਰ ਵਿੱਚ ਬਹੁਤ ਸਾਰੇ ਬਦਲਾਵ ਆਉਂਦੇ ਹਨ ਸਾਡੀ ਸੁੰਦਰਤਾ ਵੱਧਦੀ ਹੈ ਸਾਡੀ ਸਿਹਤ ਅੱਛੀ ਹੁੰਦੀ ਹੈ ਜਿਹਦੇ ਕਰਕੇ ਸਾਡਾ ਪਰਸਨੈਲਿਟੀ ਵੀ ਬਹੁਤ ਵਧੀਆ ਹੋ ਜਾਂਦੀ ਹੈ